ਹੈਲੋ ਮੈਂ ਗੁਰਦਾਸਪੁਰ ਤੋਂ ਕੁਮਾਰੀ ਬੋਲ ਰਹੀ ਹਾਂ ਹਾਂਜੀ ਮੈਂ ਨੰਬਰ ਦੱਸਦੀ ਪਈ ਹੈ ਤੁਹਾਨੂੰ ਛੇ ਸੌ ਸੱਤਰ ਪੰਜ ਸੌ ਨੱਬੇ ਇੱਕ ਸੌ ਪਝੱਤਰ ਪੈਂਤੀ ਪੰਦਰ੍ਹਾਂ